ਜਿਵੇਂ ਕਿ ਤੁਸੀਂ ਜਾਣਦੇ ਹੋ ਪਾਣੀ ਦਾ ਪ੍ਰਯੋਗ ਅਸੀਂ ਹਰ ਦਿਨ ਕਰਦੇ ਰਹਿੰਦੇ ਹਾਂ ਪ ਪਾਣੀ ਦਾ ਪ੍ਰਯੋਗ ਹਰ ਇੱਕ ਚੀਜ਼ 'ਤੇ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਦਿਨ ਤੋਂ ਲੈ ਕੇ ਰਾਤ ਤੱਕ ਪਾਣੀ ਦਾ ਹੀ ਪ੍ਰਯੋਗ ਹੁੰਦਾ ਹੈ ਜਿਵੇਂ ਕਿ ਤ ਅਸੀਂ ਨਹਾਉਣਾ ਹੋਵੇ ਤਾਂ ਸਾਨੂੰ ਪਾਣੀ ਦਾ ਪ੍ਰਯੋਗ ਕਰਨਾ ਪੈਂਦਾ ਹੈ ਅਤੇ ਰੋਟੀ ਬਣਾਉਣੀ ਹੋਵੇ ਤਾਂ ਉਸ ਵਿੱਚ ਪਾਣੀ ਦਾ ਪ੍ਰਯੋਗ ਹੁੰਦਾ ਹੈ ਅਤੇ ਆਟਾ ਗੁੰਨਣਾ ਹੋਵੇ ਉਸ ਵਿੱਚ ਵੀ ਪਨ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਪਾਣੀ ਬਿਨਾਂ ਸਾਡੀ ਕੋਈ ਜ਼ਿੰਦਗੀ ਨਹੀਂ ਹੈ ਪਾਣੀ ਹਰ ਜਗ੍ਹਾ ਜ਼ਿਆਦਾਤਰ ਕੱਪੜੇ ਧੋਣ ਕੱਪੜੇ ਵਾਸ਼ ਕਰਨ ਵਿੱਚ ਵੀ ਸਾਡਾ ਪਾਣੀ ਯੂਜ ਹੁੰਦਾ ਹੈ ਪਾਣੀ ਹਰ ਇੱਕ ਜਗ੍ਹਾ ਕੰਮ ਆਉਂਦਾ ਹੈ ਪਾਣੀ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਆ ਪਰ ਜੇ ਅਗਰ ਅਸੀਂ ਪਾਣੀ ਨਹੀਂ ਪੀਵਾਂਗੇ ਤਾਂ ਸਾਡਾ ਅਸੀਂ ਬਿਮਾਰ ਵੀ ਹੋ ਸਕਦੇ ਹਾਂ ਪਾਣੀ ਨਾਲ ਹੀ ਸਾਡਾ ਸ ਸਰੀਰ ਪਲਦਾ ਹੈ ਅਤੇ ਪਾਣੀ ਨਾਲ ਹੀ ਸਾਡੇ ਜੀ ਸਾਡੇ ਵਿੱਚ ਜਾਨ ਆਉਂਦੀ ਹੈ ਪਾਣੀ ਨਾਲ ਹੀ ਸਾਡਾ ਅਗਰ ਕੋਈ ਜ਼ਿਆਦਾ ਗਰਮੀ ਵਿੱਚ ਪਾਣੀ ਨਹੀਂ ਮਿਲਦਾ ਤਾਂ ਅਸੀਂ ਜ਼ਿਆਦਾਤਰ ਬਿਮਾਰ ਹੋ ਜਾਂਦੇ ਹਾਂ ਪਾਣੀ ਨਾਲ ਹੀ ਸਾਨੂੰ ਸੁੱਖ ਅਤੇ ਸੰਤੁਸ਼ਟੀ ਮਿਲਦੀ ਆ ਪਾਣੀ ਹਰ ਇੱਕ ਜਗ੍ਹਾ ਅਗਰ ਅਸੀਂ ਰੋਟੀ ਖਾ ਲੈਂਦੇ ਹਾਂ ਉਸ ਤੋਂ ਬਾਅਦ ਵੀ ਪਾਣੀ ਪੀਣਾ ਚਾਹੀਦਾ ਹੈ ਪਾਣੀ ਪਾਣੀ ਸਾਡੇ ਅੰਦਰ ਦੇ ਜਿੱਦਾਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਅਤੇ ਪਾਣੀ ਵਿੱਚ ਕਈ ਮੀਨਰਲਸ ਹੁੰਦੇ ਹੈ ਜਿਹੜੇ ਸਾਡੀ ਕਮਜ਼ੋਰੀ ਨੂੰ ਦੂਰ ਕਰਦੇ ਹਨ ਅਤੇ ਉਹਨਾਂ ਉਹਨਾਂ ਬਾਰੇ ਕਈ ਕੁਝ ਮੁਸੀਬਤਾਂ ਵਗੈਰਾ ਤਾਂ ਆ ਜਾਂਦੀਆਂ ਹਨ ਪਾਣੀ ਉਸੇ ਤਾਕਤ ਤਾਕਤਵਰ ਚੀਜ਼ ਹੁੰਦੀ ਹੈ ਜਿਹੜੀ ਸਾਡੀ ਅੰਦਰ ਦੀ ਬਿਮਾਰੀਆਂ ਨੂੰ ਦੂਰ ਕਰਦੀ ਹੈ ਧੰਨਵਾਦ